ਹਾਂਜੀ ਮੈਂ ਫਾਜਿਲਕਾ ਪੰਜਾਬ ਤੋਂ ਬੋਲ ਰਿਹਾ ਜੀ ਮੇਰਾ ਨਾਮ ਰਾਹੁਲ ਹੈ ਜੀ ਹੁਣ ਇੱਕ ਪਿੱਛੇ ਥੋੜੇ ਕੁ ਚਿਰ ਦੀ ਗੱਲ ਹੈ ਜੀ ਮੈਂ ਹੁਣੇ ਟਰੇਨ ਦੇ ਵਿੱਚ ਗਿਆ ਸੀਗਾ ਸਫਰ ਕੀਤਾ ਸੀ ਮੈਂ ਐਕਚੁਲੀ ਵੈਸੇ ਮੈਨੂੰ ਨਾ ਟਰੇਨ ਦਾ ਸਫਰ ਕਰ ਚ ਬਹੁਤ ਵਜਾ ਆਉਂਦਾ ਮੈਂ ਕੋਸ਼ਿਸ਼ ਕਰਦਾ ਕਿ ਮੈਂ ਕਿੱਥੇ ਵੀ ਜਾਣਾ ਹੋਵੇ ਤਾਂ ਮੈਂ ਟਰੇਨ ਹੀ ਚੁਣਾ ਕਿਉਂਕੀ ਟਰੇਨ ਦਾ ਸਫਰ ਨਾ ਇੱਕ ਤਾਂ ਅਰਾਮਦਾਇਕ ਹੁੰਦਾ ਤੇ ਲੰਬੀ ਦੂਰੀ ਵਾਸਤੇ ਵੀ ਟਰੇਨ ਦਾ ਸਫਰ ਸਭ ਤੋਂ ਵਧੀਆ ਹੁੰਦਾ ਇਸ ਵਿੱਚ ਬੰਦਾ ਆਰਾਮ ਨਾਲ ਆਪਣੀ ਸੀਟ ਰਿਜਰਵ ਕਰਾ ਕੇ ਸੋ ਸਕਦਾ ਜਾ ਸਕਦਾ ਮੈਂ ਇਸ ਕਰਕੇ ਤੁਹਾਨੂੰ ਇਹ ਦੱਸ ਰਿਹਾ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਮੈਂ ਹੁਣ ਇਹ ਪਿੱਛੇ ਫਾਜਲਕਾ ਤੋਂ ਮੈਂ ਇਨਾ ਖੁਸ਼ ਹੋ ਜਾਣਾ ਮੈਂ ਕਿ ਯਾਰ ਕਿ ਇੰਡੀਆ ਵਿੱਚ ਵੀ ਇਨਾ ਵਧੀਆ ਹੋਣ ਲੱਗ ਗਿਆ ਹੁਣ ਤਾਂ ਮਤਲਬ ਪਹਿਲਾਂ ਆਪਾਂ ਵੇਖਦੇ ਸੀ ਕਿ ਆਪਣੀ ਇੰਡੀਆ ਵਿੱਚ ਟ੍ਰੇਨਾਂ ਦੀ ਮਤਲਬ ਖਸਤਾ ਹਾਲਤ ਹੁੰਦੀ ਸੀ ਇਹਨਾਂ ਵਧੀਆ ਨਹੀਂ ਹੁੰਦਾ ਸੀ ਕਹਿਣ ਦਾ ਮਤਲਬ ਹੁਣ ਤਾਂ ਬਹੁਤ ਵਧੀਆ ਤਾਂ ਬੜਾ ਚੇਂਜ ਆ ਗਿਆ ਮਤਲਬ ਕਿ ਮੈਂ ਬੜੀ ਖੁਸ਼ ਹੋਈ ਮੈਨੂੰ ਮੈਂ ਕਿਹਾ ਮੈਂ ਥੋੜਾ ਦੱਸਾ ਾ ਸੀ ਤੁਹਾਨੂੰ ਫਿਰ ਤੁਹਾਨੂੰ ਫੀਡ ਤਾਂ ਇੱਕ ਮਹੀਨੇ ਤਾਂ ਕਿ ਤੁਸੀਂ ਹੋਰ ਇੱਕਦ ਕਮੀ ਦੱਸ ਵੀ ਪਾਵਗਾ ਸ ਨੂੰ ਸੁਧਾਰ ਕਰ ਸਕੋ ਮੈਨੂੰ ਬੋੜੇ ਬੜਾ ਵਧੀਆ ਲੱਗਿਆ ਕੋਈ ਕਦੀ ਕਮੀ ਦੱਸਦੀ ਪਾਵ ਵੈਸੇ ਕਮੀ ਹੈ ਨਹੀਂ ਦੱਸਣ ਨੂੰ ਕਦੀ ਕਮੀ ਦੱਸੀ ਪਾਓ ਤੁਸੀਂ ਹੁਣ ਸੁਧਾਰ ਕਰ ਸਕੋ ਮੈਨੂੰ ਬੜੇ ਬੜਾ ਵਧੀਆ ਲੱਗਿਆ ਬੜੀ ਖੁਸ਼ੀ ਖੁਸ਼ੀ ਮਾਨ ਮਹਿਸੂਸ ਹੋਇਆ ਕਿ ਮੈਨੂੰ ਬੜੇ ਮੈਂ ਜਦੋਂ ਟ੍ਰੇਨ ਵਿੱਚ ਗਿਆ ਮੇਰਾ ਜਾਂਦੇ ਸੀ ਬਹੁਤ ਵਧੀਆ ਮੈਨੂੰ ਇੱਕ ਤਰਾਂ ਸਵਾਗਤ ਕਹਿ ਲੋ ਕਿ ਜਿਹੜਾ ਕਿ ਜਿਹੜਾ ਟ੍ਰੇਨ ਟ੍ਰੇਨਿੰਗ ਉਹ ਇਹ ਕਹਿ ਲਓ ਕਿ ਹੁੰਦੇ ਆ ਜਿਹੜੇ ਉਹਨਾਂ ਨੇ ਮੈਨੂੰ ਕਿਹਾ ਕਿ ਸਰ ਆਓ ਸਰ ਤੇ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਉਹਨਾਂ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਤੇ ਇੱਕ ਬੈਡਸ਼ੀਟ ਸੀਗੀ ਤੇ ਪੀਲੋ ਲੈ ਕੇ ਦਿੱਤਾ ਤੇ ਉਸ ਤੋਂ ਬਾਅਦ ਖੁਦ ਹੀ ਉਹਨੂੰ ਅਰੇਂਜ ਕਰਕੇ ਗਏ ਪਿੱਲੋ ਤੇ ਬੈਡਸ਼ੀਟ ਨੂੰ ਮੈਂ ਕੁਝ ਵੀ ਨਹੀਂ ਕੀਤਾ ਵਾ ਸਾਈਡ ਤੇ ਖੜਾ ਸੀਗਾ ਆਰਾਮ ਨਾਲ ਕਈ ਉਹਨਾਂ ਨੇ ਵਧੀਆ ਰੇਜ ਕੀਤਾ ਮੈਨੂੰ ਤੇ ਉਹਨਾਂ ਨੇ ਮੈਨੂੰ ਜਾਂਦੇ ਜਾਂਦੇ ਕਹਿ ਗਏ ਕਿ ਸੱਤ ਕੋਈ ਵੀ ਜਰੂਰਤ ਹੋਵੇ ਤਾਂ ਸਾਨੂੰ ਮਸਾ ਨੂੰ ਆਵਾਜ਼ ਮਾਰੀ ਅਸੀਂ ਨਾਉ ਨਾਲ ਹਾਜ ਹੋ ਜਾਾਂਗੇ ਉਸ ਤੋਂ ਬਾਅਦ ਕੀ ਹੋਇਆ ਉਸ ਤੇ ਉਹਨਾਂ ਨੇ ਮੈਨੂੰ ਜਲਦੀ ਕਹਿ ਗਏ ਕਿ ਸਰ ਤੁਹਾਨੂੰ ਕੋਈ ਵੀ ਜਰੂਰਤ ਹੋਵੇ ਤਾਂ ਸਾਨੂੰ ਆਵਾਜ਼ ਮਾਰ ਲਈ ਅਸੀਂ ਨਾਲ ਨਾਲ ਹਾਜੀ ਹੋ ਜਾਾਂਗੇ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਆਏ ਮੇਰੇ ਕੋਲ ਫਿਰ ਖਾਨ ਨੇ ਪੁੱਛਣ ਵਾਸਤੇ ਆਏ ਕਿ ਸਰ ਖਾਣਾ ਕੀ ਖਾਓਗੇ ਇਹ ਮੈਂ ਪੁੱਛਿਆ ਤੁਹਾਡੇ ਕੋਲ ਕੀ ਕੀ ਅਵੇਲੇਬਲ ਹੈ ਤੇ ਕਿਹਾ ਸਰ ਮੈਂ ਸਾਡੇ ਕੋਲ ਤਾਂ ਦੋ ਤਿੰਨ ਚੀਜ਼ਾਂ ਹੈਗੀਆਂ ਮਤਲਬ ਕਿ ਤੇ ਇਹ ਤੁਸੀਂ ਖਾਣਾ ਚਾਹੋਗੇ ਅਸੀਂ ਉਹ ਦੇ ਦਾਂਗੇ ਤੇ ਮੈਂ ਉਹਨਾਂ ਨੂੰ ਫਿਰ ਕਿਹਾ ਕਿ ਤੁਸੀਂ ਰਾਈਸ ਲਿਆਓ ਇੱਕ ਮਿਕਸ ਦਾ ਚ ਲਿਆਓ ਤੇ ਇੱਕ ਕੋਈ ਸਬਜ਼ੀ ਹੈਗੀ ਹ ਕੋਈ ਦਾਲ

ਐਵੇਂ ਵੀ ਨਿੱਕੀ ਪਈ ਠੰਡਾ ਮਿਰਚ ਦਾ ਹੈਗਾ ਕੀਤਾ ਸੀਗਾ ਵਧੀਆ ਗਰਮ ਫਰੈਸ਼ ਮਾਲ ਦਿੱਤਾ ਮੈਨੂੰ ਉਹਨਾਂ ਨੇ ਮੈਨੂੰ ਖਾ ਕੇ ਮਜ਼ਾ ਆ ਗਿਆ ਮੈਂ ਘਰ ਵਰਗਾ ਲੱਗਿਆ ਮੈਨੂੰ ਇੱਕ ਚੀਜ਼ ਸਹੀ ਦੱਸਾ ਤੇ ਮੈਨੂੰ ਲੱਗਿਆ ਕੀ ਮੈਂ ਕਰੀ ਮੈਂ ਘਰ ਵਰਗਾ ਲੱਗਿਆ ਮੈਨੂੰ ਐਕਚੁਲੀ ਸੇ ਦੱਸ ਸਕਦਾ ਮੈਂ ਤੇ ਮੈਨੂੰ ਲੱਗਿਆ ਕੀ ਮੈਂ ਘਰੇ ਹੀ ਬੈਠਿਆ ਸੀਗਾ ਕਿ ਟਰੇਨ ਚ ਇੰਨਾ ਵਧੀਆ ਵੀ ਚੀਜ਼ ਮੈਨੂੰ ਮਿਲ ਸਕਦੀ ਹ ਕਿਉਂਕਿ ਮੈਂ ਪਹਿਲਾਂ ਟ੍ਰੇਨ ਚ ਦੇਖਦੇ ਹੁੰਦੇ ਸੀ ਕਿ ਪਹਿਲੀ ਗੱਲ ਤਾਂ ਖਾਣਾ ਹੀ ਨਹੀਂ ਦਿੰਦੇ ਸੀ ਖਾਣਾ ਦਿੰਦੇ ਇਸ ਤੋਂ ਬਾਅਦ ਜੀ ਹੋਇਆ ਕੀ ਜੀ ਮੇਰੇ ਨਾਲ ਥੋੜੇ ਵੀਰ ਜਿੱਥੇ ਮੇਰਾ ਡਿਪਾਰਟਮੈਂਟ ਸੀਗਾ ਜਿੱਥੇ ਮੇਰੀ ਸੀਟ ਸੀਗੀ ਉਹ ਸ ਥੋੜਾ ਜਿਹਾ ਨਾ ਵੇਖਿਆ ਨਾ ਕਿ ਥੋੜਾ ਪੂਰਾ ਬਹੁਤ ਪਿਆ ਸੀਗਾ ਜਿਵੇਂ ਕੁਰਕਰੇ ਮਤਲਬ ਪੂਰਾ ਬੋਤ ਪਿਆ ਸੀਗਾ ਜਿਵੇਂ ਕੁਰਕਰੇ ਪੈਕੇਟ ਹੋ ਗਏ ਚਾਹੇ ਦਾ ਕੱਪ ਹੋ ਗਿਆ ਕੋਈ ਮੂੰਫਲੀ ਅਗਾੜੇ ਹੋ ਗਏ ਤੇ ਮੈਂ ਉਹਨਾਂ ਨੂੰ ਬੁਲਾਇਆ ਮੈਂ ਕਿਹਾ ਸਾਰੇ ਹੋ ਸਕੇ ਤਾਂ ਸਾਫ ਕਰਵਾ ਦੋ ਉਹਨੇ ਨਾਲ ਇੱਕ ਬੰਦਾ ਆ ਉਹਨਾਂ ਨਾਲ ਨਾਲ ਸਾਫ ਸਫਾਈ ਕੀਤੀ ਵਧੀਆ ਤਰੀਕੇ ਨਾਲ ਤੇ ਸਾਨੂੰ ਕਹਿ ਕੇ ਗਿਆ ਸਰ ਸੋਈ ਮੈਂ ਧਿਆਨ ਨਹੀਂ ਦਿਆ ਹੋਏਗਾ ਸ਼ਾਇਦ ਵੈਸੇ ਮੈਂ ਸਫਾਈ ਉਹੀ ਸੀ ਪਹਿਲਾਂ ਪਰ ਮੈਂ ਤੇ ਮੈਂ ਉਹਨਾਂ ਨੂੰ ਬੁਲਾਇਆ ਮੈਂ ਕਿਹਾ ਸਰ ਹੋ ਸਕੇ ਤਾਂ ਸਾਫ ਕਰਾ ਦੋ ਉਹਨੇ ਨਾਲੋ ਨਾਲ ਇੱਕ ਬੰਦਾ ਆ ਉਹਨਾਂ ਨੇ ਨਾਲ ਨਾਲ ਸਾਫ ਸਫਾਈ ਕੀਤੀ ਵਧੀਆ ਤਰੀਕੇ ਨਾਲ ਤੇ ਸਾਨੂੰ ਕਹਿ ਕੇ ਗਿਆ ਸਰ ਸੋਈ ਮੈਂ ਧਿਆਨ ਨਹੀਂ ਦਿਆ ਹੋਏਗਾ ਸ਼ਾਇਦ ਅਸੀਂ ਮੈਂ ਸਫਾਈ ਉਹੀ ਸੀ ਪਹਿਲਾਂ ਪਰ ਮੈਂ ਇਹੀ ਕਹਿਣਾ ਚਾਹਾਂਗਾ ਕਿ ਬਸ ਕਮੀ ਤਾਂ ਕੋਈ ਵੀ ਨਹੀਂ ਸੀ ਜੀ ਕਮੀ ਮੈਂ ਐਵੇਂ ਹੀ ਕਵਾਂ ਤਾਂ ਕਮੀ ਕੋਈ ਵੀ ਨਹੀਂ ਸੀ ਮੈਂ ਬਸ ਇਹੀ ਚਾਹਾਂਗਾ ਕਿ ਅੱਗੇ ਵੀ ਇਹੋ ਜਿਹੇ ਹੀ ਇਹੋ ਜਿਹੇ ਸੁਵਿਧਾਵਾਂ ਰੇਲ ਯਾਤਰਾ ਨੂੰ ਮਿਲਦੀਆਂ ਰਹਿਣ ਐਵੇਂ ਨਾ ਹੋਵੇ ਕਿ ਅੱਗੇ ਜਾ ਕੇ ਚੀਜ਼ਾਂ ਬੰਦ ਹੋ ਜਾਣ